ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਮੇਰੀ ਗੱਲ ਸਬ ਇੰਸਪੈਕਟਰ ਜੋਤੀ ਕੌਰ ਨਾਲ ਹੋ ਰਹੀ ਹੈ ਓ ਮੈਡਮ ਗੱਲ ਨਾ ਇੱਦਾਂ ਆ ਕਿ ਜਿਹੜਾ ਸਾਡਾ ਇਲਾਕਾ ਹੈਗਾ ਨਾ ਹਰਗੋਬਿੰਦਪੁਰਾ ਗਲੀ ਨੰਬਰ ਇੱਕ ਉੱਥੇ ਨਾ ਸਾਡੀ ਗਵਾਂਡੀਆਂ ਦੀ ਚੋਰੀ ਹੋ ਗਈ ਆ ਅਤੇ ਮੈਂ ਨਾ ਤੁਹਾਨੂੰ ਕੰਪਲੇਨ ਕਰਨੀ ਸੀਗੀ ਉਸ ਬਾਰੇ ਉਹਨਾਂ ਦਾ ਨਾ ਫੋਨ ਫੋਨ ਵਗੈਰਾ ਸਭ ਕੁਛ ਚੋਰੀ ਹੋ ਗਿਆ ਆ ਤਾਂ ਉਹ ਫੋਨ ਨਹੀਂ ਕਰ ਸਕਦੇ ਅਤੇ ਉਹਨਾਂ ਦੀ ਕੰਪਲੇਨ ਜਿਹੜੀ ਆ ਉਹ ਮੈਨੂੰ ਉਹਨਾਂ ਨੇ ਕਿਹਾ ਹੈ ਆ ਤਾਂ ਮੈਂ ਕਰ ਰਹੀ ਆਂ ਮੈਡਮ ਓ ਹਾਂਜੀ ਉਹਨਾਂ ਦਾ ਐਡਰੈਸ ਗਲੀ ਨੰਬਰ ਇੱਕ ਹਰਗੋਬਿੰਦਪੁਰਾ ਹਾਂਜੀ ਮੈਡਮ ਠੀਕ ਆ ਹਾਂਜੀ ਹਾਂਜੀ ਮੈਡਮ ਹਾਂਜੀ ਮੈਡਮ ਮੈਡਮ ਅਗਰ ਪੋਸੀਬਲ ਹੋਵੇ ਤਾਂ ਥੋੜ੍ਹਾ ਜਲਦੀ ਕਰ ਦਿਓ ਓਕੇ ਮੈਡਮ ਧੰਨਵਾਦ ਠੀਕ ਆ ਜੀ